ਸਾਡੇ ਟਾਈਮ ਵੇਲੇ ਬਰਡਿੰਗ ਕਲੱਬ ਵਗੈਰਾ ਨਹੀਂ ਹੁੰਦੇ ਸਨ ਅਸੀਂ ਸਿਰਫ ਖੇਤਾਂ ਦੇ ਵਿੱਚ ਹੀ ਪੰਛੀਆਂ ਨੂੰ ਚਹਿਚਹਾਉਂਦੇ ਦਰਖਤਾਂ ਉੱਤੇ ਦੇਖਦੇ ਸੀਗੇ ਅਤੇ ਅਸੀਂ ਉਹਨਾਂ ਨੂੰ ਚੋਗਾ ਵੀ ਪਾਉਂਦੇ ਪਾਣੀ ਵੀ ਧਰਦੇ ਉਹਨਾਂ ਦੇ ਆਲ੍ਹਣੇ ਬਣਾਉਂਦੇ ਉਹਨਾਂ ਦੇ ਰਹਿਣ ਵਾਸਤੇ ਛੋਟੇ ਛੋਟੇ ਘਰ ਵੀ ਬਣਾ ਕੇ ਦਿੰਦੇ ਟਿੱਬਿਆਂ ਦੇ ਵਿੱਚ ਕਿ ਉਦੋਂ ਕੋਈ ਬਾਗ ਵਗੈਰਾ ਵੀ ਘੱਟ ਹੁੰਦੇ ਸੀਗੇ ਅਤੇ ਸਾਨੂੰ ਪੰਛੀ ਚਹਿਚਹਾਉਂਦੇ ਬਹੁਤ ਪਿਆਰੇ ਲੱਗਦੇ ਨੇ ਅਤੇ ਅਸੀਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਾਂ ਸੁਬਹਾ ਉੱਠਣ ਵੇਲੇ ਸ਼ਾਮ ਨੂੰ ਸੌਣ ਵੇਲੇ ਅੱਡੋ ਅੱਡੀ ਆਵਾਜ਼ਾਂ ਕੱਢ ਕੇ ਸਾਡੇ ਮਨ ਨੂੰ ਸਕੂਨ ਮਿਲਦਾ ਇਹਨਾਂ ਨੂੰ ਸੁਣ ਕੇ ਅਤੇ